ਸਤਿ ਸ਼੍ਰੀ ਅਕਾਲ ਮੈਂ ਕਾਰਤਿਕ ਪਠਾਨਕੋਟ ਤੋਂ ਬੋਲ ਰਿਹਾ ਹਾਂ ਪੰਜਾਬੀ ਸਾਡੀ ਮਾਂ ਬੋਲੀ ਹੈ ਇਹ ਸਾਡੀ ਮਾਤਰ ਭਾਸ਼ਾ ਹੈ ਪੰਜਾਬੀ ਸਾਡੇ ਪੰਜਾਬ ਵਿੱਚ ਬਹੁਤ ਬਹੁਤ ਹਾਈ ਲੈਵਲ 'ਤੇ ਬੋਲੀ ਜਾਂਦੀ ਹੈ ਪੰਜਾਬ ਵਿੱਚ ਪੰਜਾਬੀ ਦਾ ਬਹੁਤ ਮਹੱਤਵ ਹੈ ਇਸ ਕਰਕੇ ਸਾਨੂੰ ਪੰਜਾਬੀ ਬਹੁਤ ਵੱਧ ਤੋਂ ਵੱਧ ਬੋਲਣੀ ਚਾਹੀਦੀ ਹੈ ਸਾਡੇ ਅੱਜ ਕੱਲ੍ਹ ਪੁਸਤਕਾਂ ਵਿੱਚ ਵੀ ਪੰਜਾਬੀ ਆਮ ਹੋ ਗਈ ਹੈ ਸਾਡੇ ਔਨਲਾਈਨ ਵੀ ਜ਼ਿਆਦਾ ਤੋਂ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਪੰਜਾਬੀ ਦੀ ਮਹੱਤਤਾ ਹੈ ਸਾਡੇ ਗੇਮਾਂ ਵਿੱਚ ਵੀ ਪੰਜਾਬੀ ਪੰਜਾਬੀ ਹੀ ਚੱਲਦੀ ਹੈ ਅੱਜ ਕੱਲ੍ਹ ਕੰਪਿਊਟਰਾਂ 'ਤੇ ਵੀ ਪੰਜਾਬੀ ਲਾਜ਼ਮੀ ਹੋ ਗਈ ਹੈ ਪੰਜਾਬੀ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਰੱਖਦੀ ਹੈ ਇਹ ਸਾਡੀ ਸਾਡੇ ਜਿਉਣ ਵਿੱਚ ਕਾਫ਼ੀ ਜ਼ਿਆਦਾ ਮਹੱਤਤਾ ਹੈ ਇਸਦੀ ਸਾਡੇ ਵੀਡੀਓ ਗੇਮਸ ਹੋਰ ਵੀ ਕੰਪਿਊਟਰ ਹੋਰ ਵੀ ਕੀਸ ਵਗੈਰਾ ਇਹਨਾਂ ਦੇ ਵਿੱਚ ਪੰਜਾਬੀ ਜ਼ਿਆਦਾ ਬਹੁਤ ਹੀ ਵੱਧ ਵੱਧ ਯੂਸ ਹੁੰਦੀ ਹੈ ਪੰਜਾਬ ਪੰਜਾਬ ਵਿੱਚ ਪੰਜਾਬੀ ਦਾ ਬਹੁਤ ਮਹੱਤਵ ਹੈ ਪੰਜਾਬੀ ਦੇ ਬਿਨਾਂ ਪੰਜਾਬ ਸੁੰਨਾ ਸੁੰਨਾ ਜਿਹਾ ਲੱਗਦਾ ਹੈਗਾ ਹੈ ਜੋ ਪੰਜਾਬੀ ਸਾਡੇ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਪੰਜਾਬੀ ਅੱਜ ਕੱਲ੍ਹ ਆਮ ਹੋ ਗਈ ਹੈ ਜੰਮਦੇ ਪੈਦਾ ਹੁੰਦੇ ਬੱਚੇ ਵੀ ਪੰਜਾਬੀ ਸਿੱਖ ਲੈਂਦੇ ਹਨ ਆਪਣੀ ਮਾਂ ਆਪਣੀ ਮਾਂ ਬੋਲੀ ਆਪਣੇ ਬੱਚੇ ਆਪਣੀ ਮਾਵਾਂ ਆਪਣੇ ਬੱਚਿਆਂ ਨੂੰ ਬਹੁਤ ਜਲਦੀ ਸਿਖਾ ਦਿੰਦੀਆਂ ਹਨ ਜਿਸ ਕਰਕੇ ਸਾਡੀ ਮਾਂ ਬੋਲੀ ਪੰਜਾਬੀ ਸਾਰਿਆਂ ਨੂੰ ਕਾਫ਼ੀ ਹੱਦ ਤੱਕ ਬਹੁਤ ਹੀ ਜਲਦੀ ਆ ਜਾਂਦੀ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਪੰਜਾਬੀ ਵੱਧ ਤੋਂ ਵੱਧ ਬੋਲਣੀ ਚਾਹੀਦੀ ਹੈ ਧੰਨਵਾਦ